ਪੰਜਾਬ ਵਿੱਚ ਯੂਨੀਵਰਸਿਟੀ ਅਤੇ ਕਾਲਜਾਂ ਲਈ ਦਾਖਲਾ ਲੈਣ ਲਈ ਓਨਲਾਈਨ ਪ੍ਰਕਿਰਿਆ ਹੁੰਦੀ ਹਨ ਜਿਸ ਵਿੱਚ ਓਨਲਾਈਨ ਰਜਿਸਟ੍ਰੇਸ਼ਨ ਫਾਰਮ ਭਰੇ ਜਾਂਦੇ ਹਨ ਉਸ ਤੋਂ ਬਾਅਦ ਉਹ ਸਾਨੂੰ ਪਰਵੇਸ਼ ਪ੍ਰੀਖਿਆ ਲਈ ਬੁਲਾਉਂਦੇ ਹਨ ਅਤੇ ਉਸ ਦੇ ਅਕੋਡਿੰਗ ਜੋ ਸਾਨੂੰ ਗਰੇਡ ਮਿਲਦਾ ਹੈ ਉਸ ਦੇ ਨਿਰਧਾਰਿਤ ਕੀਤੇ ਸਥਾਨ ਸਾਨੂੰ ਦਿੱਤਾ ਜਾਂਦਾ ਹੈ ਅਤੇ ਇਸ ਪ੍ਰਕਾਰ ਸਾਡੇ ਪੰਜਾਬ ਦੇ ਵਿੱਚ ਯੂਨੀਵਰਸਿਟੀ ਅਤੇ ਕੋਲਜਾਂ ਵਿੱਚ ਸਾਡਾ ਦਾਖਲਾ ਕੀਤਾ ਜਾਂਦਾ ਹੈ